ਤੁਸੀਂ ਸਹੀ ਕਹਿ ਰਹੇ ਹੋ ਕਿ ਪਿਛਲੇ ਕੁਝ ਸਾਲਾਂ ਵਿੱਚ ਡਾਂਸਿੰਗ ਬਦਲ ਗਈ ਹੈ ਕਿਉਂਕਿ ਵੈਸਟਰਨ ਕਲਚਰ ਨੇ ਆ ਕੇ ਆਪਣੀ ਸੰਸਕ੍ਰਿਤੀ ਨੂੰ ਖਤਮ ਕਰ ਦਿੱਤਾ ਹੈ ਨਵੇਂ ਨਾਚਾਂ ਨਾਲੋਂ ਪੁਰਾਣੇ ਨਾਚ ਬੰਦ ਹੋ ਰਹੇ ਹਨ ਕਿਉਂਕਿ ਨਵੇਂ ਨਾਚਾਂ ਵਿੱਚ ਹੁਸ਼ਰ ਹੁਸ਼ਰ ਗੰਦੇ ਸੀਨ ਵੇਖੇ ਜਾ ਰਹੇ ਹਨ ਬੱਚੇ ਅੱਜ ਕੱਲ੍ਹ ਦੇ ਵੈਸਟਰਨ ਕਲਚਰ ਨੂੰ ਅਪਣਾ ਰਹੇ ਨੇ ਕੁਝ ਆਪਣੇ ਸ ਸੱਭਿਅਤਾ ਦੇ ਲੋਕ ਬਾਹਰੀ ਦੇਸ਼ਾਂ ਨੂੰ ਵਿੱਚ ਜਾ ਕੇ ਆਪਣੀ ਬਾਹਰੀ ਦੇਸ਼ਾਂ ਦੀ ਸੰਸਕ੍ਰਿਤੀ ਦਾ ਪ੍ਰਚਾਰ ਆਪਣੇ ਦੇਸ਼ਾਂ ਵਿਚ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਇਹ ਡਾਂਸ ਜ਼ਿਆਦਾ ਵਧੀਆਂ ਹਨ ਪਰ ਜਿਹੜੇ ਆਪਣੇ ਨਾਚ ਨੇ ਆਪਣੀ ਸੰਸਕ੍ਰਿਤੀ ਦੇ ਨਾਚ ਬਹੁਤ ਵਧੀਆ ਹਨ ਇਹਦੇ 'ਚ ਦੇਸ਼ ਪ੍ਰੇਮ ਦੀ ਭਾਵਨਾ ਆਪਣੀ ਸੰਸਕ੍ਰਿਤ ਨੂੰ ਬਚਾ ਕੇ ਰੱਖਣ ਦੀ ਭਾਵਨਾ ਪੈਦਾ ਹੁੰਦੀ ਹੈ ਨਵੇਂ ਨਾਚ ਦੁਨੀਆ ਵਿੱਚ ਗਲਤ ਭਾਵਨਾ ਦਾ ਵਿਕਾਸ ਕਰ ਰਿਹਾ ਨਸ਼ਿਆਂ ਨੂੰ ਵਧਾ ਰਹੇ ਹਨ ਅਤੇ ਮੁੰਡੇ ਕੁੜੀਆਂ ਨੂੰ ਇਸ ਬਾਰੇ ਹਜੇ ਪਤਾ ਨਹੀਂ ਇਹਨਾਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਕਿ ਨਵੇਂ ਨਾਚ ਸਾਡੀ ਸੰਸਕ੍ਰਿਤ ਨੂੰ ਬਚਾਣਗੇ ਸਾਨੂੰ ਅੱਗੇ ਵਧਾਣਗੇ ਕਿਉਂਕਿ ਜਿਹੜੀ ਵੈਸਟਰਨ ਸੱਭਿਅਤਾ ਹੈ ਉਹ ਸਾਡੇ ਲਈ ਨਹੀਂ ਬਣੀ ਸਾਨੂੰ ਆਪਣੀ ਸੱਭਿਅਤਾ ਨੂੰ ਅੱਗੇ ਬਰਕਰਾਰ ਰੱਖਣਾ ਚਾਹੀਦਾ ਹੈ ਆਪਣੀ ਸੱਭਿਅਤਾ ਨੂੰ ਬਰ ਕਰਨ ਲਈ ਆਪਾਂ ਨੂੰ ਆਪਣੇ ਨਾਚਾਂ ਨੂੰ ਹੀ ਅਪਨਾਉਣਾ ਚਾਹੀਦਾ ਹੈ ਨਵੇਂ ਨਾਚ ਦੇ ਅਸ਼ਲੀਲਤਾ ਪੂਰਨ ਹੁੰਦੇ ਹਨ ਜੋ ਆਪਣੇ ਲਈ ਸਹੀ ਨਹੀਂ ਹਨ